ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਤੁਸੀਂ ਨਵੇਂ ਨਵੇਂ ਆਏ ਹੋ ਹਾਂਜੀ ਅੱਛਾ ਜੀ ਤੁਸੀਂ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ 'ਚ ਘੁੰਮਣ ਵਾਸਤੇ ਜਾਣਾ ਚਾਹੁੰਦੇ ਹੋ ਜਾਂ ਕਿ ਕਿਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਅੰਮ੍ਰਿਤਸਰ ਮਸ਼ਹੂਰ ਆ ਗੋਲਡਨ ਟੈਂਪਲ ਲਈ ਸਿੱਖਾਂ ਦਾ ਕਿਉਂਕਿ ਮੇਨ ਸੈਂਟਰ ਆ ਜੀ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਖਾਲਸਾ ਕੋਲਜ ਤੁਸੀਂ ਬਿਲਡਿੰਗ ਵੇਖ ਸਕਦੇ ਹੋ ਬਹੁਤ ਵਧੀਆ ਵਾਹਗਾ ਬਾਰਡਰ ਤੁਸੀਂ ਸੈਰਮਨੀ ਵੇਖ ਸਕਦੇ ਹੋ ਅਤੇ ਅੰਮ੍ਰਿਤਸਰ ਦੇ ਵਿੱਚ ਜੇ ਤੁਸੀਂ ਘੁੰਮਣਾ ਹੋਵੇ ਤਾਂ ਇੱਕ ਦਿਨ ਘੱਟੋ ਘੱਟ ਚਾਹੀਦਾ ਜੀ ਅਤੇ ਇਸ ਤੋਂ ਹਾਂਜੀ ਹਾਂਜੀ ਅਤੇ ਇਸ ਤੋਂ ਬਾਅਦ ਜੇ ਤੁਸੀਂ ਸਪੋਰਟਸ ਦਾ ਸਮਾਨ ਖਰੀਦਣਾ ਜਾਂ ਤੁਸੀਂ ਕਿਉਂਕਿ ਵ ਵਧੀਆ ਕਲੋਨੀਜ਼ ਬਣੀਆਂ ਨੇ ਜਲੰਧਰ ਸ਼ਹਿਰ ਵੇਖੋਗੇ ਜਲੰਧਰ ਸ਼ਹਿਰ ਦੂਸਰਾ ਸਭ ਤੋਂ ਵੱਡਾ ਸ਼ਹਿਰ ਆ ਪੰਜਾਬ ਦਾ ਫਿਰ ਜਿਹਨੂੰ ਮਾਨਚੈਸਟਰ ਔਫ ਇੰਡੀਆ ਕਹਿੰਦੇ ਨੇ ਲੁਧਿਆਣਾ ਲੁਧਿਆਣਾ ਸ਼ਹਿਰ ਹੌਜ਼ਰੀ ਵਾਸਤੇ ਬਹੁਤ ਮਸ਼ਹੂਰ ਆ ਬਿਜ਼ਨਸਮੈਨ ਬਹੁਤ ਨੇ ਫਿਰ ਮੈਡੀਕਲ ਕੋਲਜ ਨੇ ਉੱਥੇ ਦੋ ਤਿੰਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗਰੂ ਅੰਗਦ ਦੇਵ ਵੀ ਵੈਟਨਰੀ ਯੂਨੀਵਰਸਿਟੀ ਇਹ ਲੁ ਲੁਧਿਆਣਾ ਬਹੁਤ ਵਧੀਆ ਸ਼ਹਿਰ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਦੇਖਣਾ ਹੋਵੇ ਵਧੀਆ ਨਿਕਾਸੀ ਜਾਂ ਵਧੀਆ ਕਹਿ ਲਉ ਕਿ ਸ਼ਹਿਰ ਜਿਹਨੂੰ ਵਧੀਆ ਡਿਵੈਲਪ ਹੋਇਆ ਮੋਹਾਲੀ ਅਤੇ ਚੰਡੀਗੜ੍ਹ ਉਹ ਤੁਸੀਂ ਦੇਖ ਸਕਦੇ ਹੋ ਅਤੇ ਤੁਸੀਂ ਦੱਸੋਗੇ ਕਦੋਂ ਕਦੋਂ ਦਾ ਪ੍ਰੋਗਰਾਮ ਬਣਾਉਣਾ ਨਹੀਂ ਮੈਂ ਤੁਹਾਨੂੰ ਵੈਸੇ ਡਿਟੇਲ ਦੇ ਦੇਵਾਂਗਾ ਸਾਰੀ ਠੀਕ ਹੈ ਜੀ ਅਤੇ ਜੇ ਕਿਸੇ ਡਰਾਈਵਰ ਦੀ ਲੋੜ ਹੋਈ ਤਾਂ ਅਸੀਂ ਡਰਾਈਵਰ ਨੂੰ ਵੀ ਭੇਜ ਦੇਵਾਂਗੇ ਤੁਸੀਂ ਤੁਸੀਂ ਅਤੇ ਭਾਅ ਜੀ ਹਾਂ ਤੁਸੀਂ ਤਾਂ ਭਾਅ ਜੀ ਪ੍ਰੋਗਰਾਮ ਬਣਾ ਲਿਓ ਮੈਂ ਤੁਹਾਨੂੰ ਹੈਲਪ ਹਰ ਤਰੀਕੇ ਨਾਲ ਹੈਲਪ ਕਰਾਂਗਾ ਜੀ ਠੀਕ ਆ ਜੀ ਮਿਹਰਬਾਨੀ ਓਕੇ ਜੀ ਓਕੇ ਜੀ ਓਕੇ ਜੀ